ਮੈਨੂੰ ਬਹੁਤ ਸਾਰੇ ਮੋਟਰਸਾਈਕਲ ਪਸੰਦ ਹੈ ਜਿਸ ਵਿੱਚ ਸਪਲੈਂਡਰ ਪਲਸਰ ਸਿਟੀ ਹੰਡਰਡ ਪਲਟੀਨਾ ਮੇਰਾ ਇਹਨਾਂ ਵਿੱਚ ਸਭ ਤੋਂ ਫੇਵਰੇਟ ਪਲਸਰ ਹੈ ਮੇਰਾ ਸੁਪਨਾ ਹੈ ਕਿ ਮੈਂ ਪਲਸਰ ਲਵਾਂ ਅਤੇ ਉਹਨੇ 'ਤੇ ਬੈਠ ਕੇ ਮੈਂ ਕਈ ਜਗ੍ਹਾ 'ਤੇ ਘੁੰਮਾ ਅਤੇ ਮੈਂ ਆਪਣੇ ਵੈਸੇ ਸਪਲੈਂਡਰ 'ਤੇ ਬੈਠ ਕੇ ਕਈ ਜਮਾਂ ਜਗ੍ਹਾ 'ਤੇ ਗਿਆ ਹੈਗਾ ਘੁੰਮਣ ਜਿਸ ਸ੍ਰੀਨਗਰ ਅਤੇ ਜੰਮੂ ਉਸ ਤੋਂ ਬਾਅਦ ਫਿਰ ਹਰਿਦੁਆਰ ਹਿਮਾਚਲ ਅਤੇ ਸ਼ਿਮਲਾ ਵੀ ਗਿਆ ਹਾਂ ਆਪਣੇ ਮੋਟਰਸਾਈਕਲ 'ਤੇ ਅਤੇ ਬਹੁਤ ਮਜ਼ਾ ਆਉਂਦਾ ਸੀਗਾ ਉੱਥੇ ਮੈਂ ਅਤੇ ਮੇਰੇ ਚਾਰ ਦੋਸਤ ਅਸੀਂ ਦੋ ਸਾਰੇ ਆਪਣੇ ਆਪਣੇ ਮੋਟਰਸਾਈਕਲ 'ਤੇ ਗਏ ਸੀਗੇ ਅਤੇ ਸਾਨੂੰ ਬਹੁਤ ਮ ਵਧੀਆ ਲੱਗਿਆ ਉੱਥੇ ਜਾ ਕੇ ਅਸੀਂ ਘੁੰਮੇ ਫਿਰੇ ਉੱਥੇ ਇੱਕ ਢਾਬੇ 'ਤੇ ਬੈਠ ਕੇ ਅਸੀਂ ਰੋਟੀ ਖਾਈ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਵਾਸਤੇ ਨਿਕਲ ਲਏ ਉੱਥੇ ਰਸਤੇ ਦੇ ਸਾਨੂੰ ਇੱਕ ਬਹੁਤ ਵਧੀਆ ਗੁੱਡਾ ਦਿਖਿਆ ਜਿਸ ਵਿੱਚ ਬਹੁਤ ਹਵਾ ਭਰਿਆ ਹੋਇਆ ਤਾਂ ਬਹੁਤ ਬੜਾ ਸੀਗਾ ਉਹ ਅਤੇ ਉਹ ਬਹੁਤ ਸੋਹਣਾ ਦਿਖਦਾ ਤਾ ਦੂਰ ਤੋਂ ਫਿਰ ਅਸੀਂ ਆਪਣੇ ਘਰਾਂ ਆ ਗਏ ਸ਼ਾਮ ਨੂੰ